ਪਸੰਦੀਦਾ ਗੀਤ ਜਿਹੜਾ ਹੈ ਉਹ ਗੁਰਦਾਸ ਮਾਨ ਦਾ ਏ ਛੱਲਾ ਅਤੇ ਜ਼ਿਆਦਾਤਰ ਗੁਰਦਾਸ ਮਾਨ ਅਤੇ ਅਮਰਿੰਦਰ ਗਿੱਲ ਨੂੰ ਸੁਣਨਾ ਪਸੰਦ ਕਰੀਦਾ ਏ ਅਤੇ ਇਹ ਜਿਹੜੇ ਹੈ ਜ਼ਿਆਦਾਤਰ ਯੂਟਿਊਬ ਤੋਂ ਹੀ ਸੁਣੀਦੇ ਹੈ ਯੂਟਿਊਬ ਦੇ ਥਰੂ ਹੀ ਜਿਹੜੇ ਇਹਨਾਂ ਦੇ ਗਾਣੇ ਸੁਣੇ ਜਾਂਦੇ ਆ